ਹਾਂਜੀ ਹਾਂਜੀ ਹੈਲੋ ਠੀਕ ਆ ਅੱਛਾ ਠੀਕ ਹੈ ਮੈਡਮ ਠੀਕ ਹੈ ਮੈਡਮ ਮੈਂ ਉਹਨਾਂ ਦੇ ਪਾਪਾ ਨੂੰ ਭੇਜ ਦਿੰਦੀ ਹਾਂ ਧਿਆਨ ਰੱਖੋ ਉਹਦਾ ਮੈਂ ਥੋੜ੍ਹੀ ਦੇਰ ਤੱਕ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤੁਸੀਂ ਉਹਨਾਂ ਦਾ ਧਿਆਨ ਰੱਖੋ ਅਸੀਂ ਥੋੜ੍ਹੀ ਦੇਰ ਤੱਕ ਤੁਹਾਡੇ ਕੋਲ ਆ ਜਾਂਦੇ ਹਾਂ ਅਸੀਂ ਤਰਨ ਤਾਰਨ ਰੋਡ ਦੇ ਬੈਕ ਸਾਈਡ 'ਤੇ ਹੀ ਰਹਿੰਦੇ ਹਾਂ ਗੁਰਦੁਆਰੇ ਦੀ ਬੈਕ ਸਾਈਡ 'ਤੇ ਠੀਕ ਹੈ ਹਾਂਜੀ